ਪੁਰਾਣੇ ਸਮਿਆਂ ਵਿੱਚ ਜਿੱਦਾਂ ਅਸੀਂ ਖੂਹ 'ਚੋਂ ਪਾਣੀ ਕੱਢਦੇ ਹੁੰਦੇ ਸੀ ਰੱਸੀ ਪਾ ਕੇ ਬਾਲਟੀਆਂ ਨਾਲ ਲਾ ਕੇ ਅਸੀਂ ਖੂਹ ਵਿੱਚੋਂ ਪਾਣੀ ਕੱਢਣਾ ਉਦੋਂ ਟਾਈਮ ਹੁੰਦੇ ਸੀ ਖੂਹ 'ਚੋਂ ਪਾਣੀ ਕੱਢਣਾ ਬੜਾ ਵਧੀਆ ਲੱਗਣਾ ਪਾਣੀ ਅਤੇ ਪਰ ਅੱਜ ਕੱਲ੍ਹ ਟ ਸਮੇਂ ਦੇ ਨਾਲ ਸਾਰਾ ਕੁਛ ਬਦਲਿਆ ਮਸ਼ੀਨਾਂ ਆ ਗਈਆਂ ਅਲ ਅਲਟਰੈਨਿਕ ਮੋਟਰਾਂ ਆ ਗਈਆਂ ਹੋਣ ਜਿਹਦੇ ਕਰਕੇ ਅਸੀਂ ਮੋਟਰਾਂ ਦੇ ਨਾਲ ਬ ਮੋਟਰਾਂ ਲਾ ਕੇ ਖੂਹ ਦੇ ਵਿੱਚੋਂ ਪਾਣੀ ਕੱਢ ਸਕਦੇ ਹਾਂ ਵੈਸੇ ਤਾਂ ਅੱਜ ਕੱਲ੍ਹ ਖੂਹ ਰਹੇ ਨਹੀਂ ਪਰ ਚਲੋ ਜਿਹਨਾਂ ਨੂੰ ਖੂਹ ਦਾ ਜਿਹਨਾਂ ਪਿੰਡਾਂ 'ਚ ਖੂਹ ਹੈਗਾ ਉਹਨਾਂ ਨੂੰ ਪਾਣੀ ਪਸੰਦ ਆ ਖੂਹਾਂ ਦੇ ਹੈ ਨਾ ਕਿ ਪੁਰਾਣੇ ਲੋਕ ਅਜੇ ਵੀ ਪਿੰਡਾਂ 'ਚ ਹੈਗੇ ਉਹ ਖੂਹ ਦਾ ਪਾਣੀ ਪੀਂਦੇ ਆ ਜਾਂ ਖੂਹ ਹੈਗੇ ਉਹਨਾਂ ਦੇ ਉਹ ਮੋਟਰਾਂ ਲਾ ਕੇ ਤਾਂ ਉਹਦੇ ਨਾਲ ਪਾਣੀ ਕੱਢਦੇ ਆ ਅਤੇ ਯਾਨੀ ਕਿ ਟਾਈਮ ਟਾਈਮ ਦੀ ਗੱਲ ਆ ਪਹਿਲਾਂ ਰੱਸੀਆਂ ਨਾਲ ਪਾਣੀ ਕੱਢਿਆ ਜਾਂਦਾ ਸੀ ਬਾਲਟੀ ਰੱਸੀ ਨਾਲ ਬਾਲਟੀ ਲਾ ਕੇ ਖੂਹ 'ਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਅੱਜ ਕੱਲ੍ਹ ਟਾਈਮ ਏ ਆਧੁਨਿਕ ਮਸ਼ੀਨਾਂ ਦਾ ਹੈ ਨਾ ਮਸ਼ੀਨਾਂ ਲਾ ਕੇ ਪਾਣੀ ਹੇ ਕੱ ਕੱਢਦੇ ਆ ਖੂਹਾਂ ਦੇ ਵਿੱਚੋਂ ਇਸ ਕਰਕੇ ਮੈਨੂੰ ਲੱਗਦਾ ਮੋਟਰ ਲਾ ਕੇ ਕੱਢਣਾ ਪਾਣੀ ਆਸਾਨ ਆ ਅਤੇ ਆਪਾਂ ਮੋਟਰ ਲਾ ਕੇ ਪਾਣੀ ਕੱਢ ਸਕਦੇ ਹਾਂ ਅਤੇ ਬਾਕੀ ਆਪਣਾ ਆਪਣਾ ਵਿਚਾਰ ਆ